ਮੈਨੂੰ ਸ਼ੁਰੂ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਚਾਹੇ ਰਸੋਈ 'ਚ ਜਿੰਨਾ ਵੀ ਟੈਮ ਲੱਗ ਜਾਵੇ ਮੇਰੇ ਮਨ ਨੂੰ ਚੈਨ ਆਉਂਦਾ ਹੈ ਜ਼ਿਆਦਾ ਟਾਈਮ ਲਗਾ ਕੇ ਰਸੋਈ ਵਿੱਚ ਖਾਣਾ ਬਣਾਉਣ ਨਾਲ ਮੈਨੂੰ ਪ੍ਰਸੰਨਤਾ ਮਿਲਦੀ ਹੈ ਅਤੇ ਮੈਂ ਨਵੀਆਂ ਨਵੀਆਂ ਰੈਸਪੀ ਚੀਜ਼ਾਂ ਬਣਾਉਣ ਦਾ ਮੈਨੂੰ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਮਿਲਦੀ ਹੈ ਅਤੇ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਨਵੀਂ ਨਵੀਂ ਕੋਈ ਚੀਜ਼ ਬਣਾ ਕੇ ਦੇਣੀ ਬੱਚੇ ਅੱਜ ਕੱਲ੍ਹ ਦੇ ਪੀਜ਼ਾ ਖਾਣਾ ਪਸੰਦ ਕਰਦੇ ਨੇ ਪਹਿਲਾਂ ਬੱਚੇ ਬਾਹਰ ਦਾ ਪੀਜ਼ਾ ਖਾਂਦੇ ਸੀ ਹੁਣ ਮੈਨੂੰ ਪੀਜ਼ੇ ਦੀ ਰੈਸਿਪੀ ਤਾਂ ਨਹੀਂ ਸੀ ਪਤਾ ਪਰ ਫਿਰ ਵੀ ਮੈਂ ਉਸਨੂੰ ਆਪਣੇ ਤਰੀਕੇ ਦੇ ਨਾਲ ਪੀਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਮੈਦੇ ਦੀ ਬੇਸ ਦੀ ਜਗ੍ਹਾ ਮੈਂ ਆਟੇ ਦਾ ਬੇਸ ਲਗਾ ਕੇ ਉਹਦੇ ਵਿੱਚ ਸਬਜ਼ੀਆਂ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਐਡ ਕਰਕੇ ਆਪਣੇ ਤਰੀਕੇ ਦੇ ਨਾਲ ਉਹਨੂੰ ਸਾਫ਼ ਸੁਥਰਾ ਸੋਹਣੇ ਢੰਗ ਨਾਲ ਬਣਾ ਕੇ ਆਪਣੇ ਬੱਚਿਆਂ ਨੂੰ ਦਿੱਤਾ ਮੇਰੇ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਉਹਨੂੰ ਖਾਧਾ ਅਤੇ ਪਸੰਦ ਕੀਤਾ ਉਹ ਹੁਣ ਬਾਹਰ ਦਾ ਪੀਜ਼ਾ ਨਹੀਂ ਖਾਂਦੇ ਘਰ ਦਾ ਪੀਜ਼ਾ ਖਾਣਾ ਪਸੰਦ ਕਰਦੇ ਨੇ ਅਤੇ ਮੈਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਡਿਸ਼ਾਂ ਬਣਾ ਕੇ ਬੱਚਿਆਂ ਨੂੰ ਖਵਾਉਂਦੀ ਹਾਂ